ਸਤਿ ਸ਼੍ਰੀ ਅਕਾਲ ਮੈਨੂੰ ਇੱਕ ਪ੍ਰੋਡਕਟ ਬਾਰੇ ਤੁਹਾਡੇ ਤੋਂ ਜਾਣਕਾਰੀ ਚਾਹੀਦੀ ਹੈ ਜੋ ਕਿ ਵੋਟ ਕੰਪਨੀ ਦਾ ਹੈਡਫੋਨ ਹੈਗਾ ਹੈ ਕੀ ਤੁਸੀਂ ਮੈਨੂੰ ਇਸ ਪ੍ਰੋਡਕਟ ਬਾਰੇ ਜਾਣਕਾਰੀ ਦੇ ਸਕਦੇ ਹੋ ਕੀ ਇਹ ਤੁਹਾਡੇ ਸਟੋਕ ਵਿੱਚ ਉਪਲਬੱਧ ਹੈ ਅਤੇ ਕੀ ਤੁਸੀਂ ਇਸ ਨੂੰ ਮੇਰੇ ਪਤੇ 'ਤੇ ਭਿਜਵਾ ਸਕਦੇ ਹੋ ਅਤੇ ਇਸ ਦਾ ਆਰਡਰ ਦੇ ਸਕਦੇ ਹੋ